ਪੰਜਾਬ ਵਿੱਚ ਮੁੱਖ ਤਾਂ ਤਿੰਨ ਪ੍ਰਕਾਰ ਦੇ ਸਕੂਲ ਹਨ ਪਹਿਲਾ ਜੋ ਹੈ ਪੰਜਾਬ ਬੋਰਡ ਹੈ ਦੂਸਰਾ ਸੀ ਪੀ ਐਸ ਸੀ ਬੋਰਡ ਹੈ ਤੀਸਰਾ ਜੋ ਕਿ ਅੰਤਰਰਾਸ਼ਟਰੀਯ ਬੋਰਡ ਜਿਹਨੂੰ ਕਿ ਅਸੀਂ ਆਈ ਸੀ ਆਈ ਬੋਰਡ ਵੀ ਕਹਿੰਦੇ ਹਾਂ ਇਹਨਾਂ ਵਿੱਚੋਂ ਸਿਲੇਬਸ ਦਾ ਬਹੁਤ ਹੀ ਪੜ੍ਹਾਉਣ ਦਾ ਫ਼ਰਕ ਹੈ ਸਕੂਲ ਕਈਆਂ ਵਿੱਚ ਸਿਲੇਬਸ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧਦਾ ਹੈ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਅਸਰ ਪੈਂਦਾ ਹੈ ਪੰਜਾਬ ਬੋਰਡ ਜਾਂ ਸੀ ਬੀ ਐਸ ਈ ਬੋਰਡ ਜਾਂ ਆਪਾਂ ਆਈ ਸੀ ਆਈ ਸੀ ਬੋਰਡ ਦੇ ਵਿੱਚ ਬੱਚੇ ਨੂੰ ਪਾਉਂਦੇ ਹਾਂ ਉਹਨਾਂ ਦੇ ਜੋ ਡਿਵੈਲਪਮੈਂਟ ਸਕੀਲਸ ਪ੍ਰਦਾਨ ਕਰਦੇ ਹਨ ਬੱਚਿਆਂ ਨੂੰ ਉਹ ਵੱਖ ਵੱਖ ਹੁੰਦੇ ਹਨ ਬੋਲਣ ਦਾ ਤਰੀਕਾ ਵੱਖਰਾ ਵੱਖਰਾ ਸਿਖਾਇਆ ਜਾਂਦਾ ਹੈ ਪੜ੍ਹਨ ਦਾ ਤਰੀਕਾ ਵੱਖਰਾ ਵੱਖਰਾ ਸਿਖਣਾ ਸਿਖਾਇਆ ਜਾਂਦਾ ਪੰਜਾਬ ਵਿੱਚ ਮੁੱਖ ਤਾਂ ਅੰਨਿਆਂ ਲਈ ਜਾਂ ਅਸੀਂ ਅਪੰਗਾਂ ਲਈ ਵੀ ਸਕੂਲ ਬਣਾਏ ਹੋਏ ਹਨ ਜਿਸ ਵਿੱਚ ਉਹ ਗਰੀਬ ਜਾਂ ਅਪੰਗ ਵਿਦਿਆਰਥੀ ਪੜ੍ਹਦੇ ਹਨ ਕਈ ਤਰ੍ਹਾਂ ਦੇ ਚੈਰੀਟੇਬਲ ਸਕੂਲ ਵੀ ਹਨ ਜਿਨ੍ਹਾਂ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਕਿ ਉਹ ਵੀ ਆਪਣੀ ਪੜ੍ਹਾਈ ਪੂਰੀ ਕਰ ਸਕਣ ਉਹ ਵੀ ਕੁਛ ਪੜ੍ਹ ਲਿਖ ਕੇ ਅੱਗੇ ਵੱਧ ਸਕਣ